ਸਾਲਾਨਾ ਮੇਲਾ ਜਿਵੇਂ ਕਿ ਵਿਸਾਖੀ ਦਾ ਮੇਲਾ ਜੋ ਹਰੇਕ ਸਾਲ ਤੇਰ੍ਹਾਂ ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਮੈਂ ਜਦੋਂ ਬਚਪਨ ਦੇ ਵਿੱਚ ਇਸ ਮੇਲੇ ਵਾਲੇ ਦਿਨ ਛੋਟਾ ਹੁੰਦਾ ਮੈਂ ਜਦੋਂ ਆਨੰਦਪੁਰ ਸਾਹਿਬ ਗਿਆ ਹੋਇਆ ਸੀ ਤਾਂ ਜਦੋਂ ਮੈਂ ਦੇਖਿਆ ਕਿ ਬੜੀ ਸ਼ਰਧਾ ਭਾਵਨਾ ਜੁੜੀ ਹੋਈ ਸੀ ਬਹੁਤ ਸੰਗਤਾਂ ਸੇਵਾ ਦੇ ਅਲੱਗ ਅਲੱਗ ਸੇਵਾ ਦੇ ਵਿੱਚ ਜੁੜੀ ਹੋਈ ਸੀ ਕੋਈ ਲੰਗਰ ਵਰਤਾ ਰਿਹਾ ਸੀ ਕੋਈ ਭਾਂਡੇ ਮਾਂਜ ਰਿਹਾ ਸੀ ਕੋਈ ਜੋੜੇ ਸਾਫ ਕਰ ਰਿਹਾ ਸੀ ਕੋਈ ਫਰਸ਼ ਸਾਫ ਕਰ ਰਿਹਾ ਸੀ ਕੋਈ ਹੱਥ ਜੋੜ ਕੇ ਨਤਮਸਤਕ ਹੁੰਦਾ ਸੀ ਸੰਗਤ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਹੁੰਦੀ ਸੀ ਵਿਸਾਖੀ ਦੇ ਦੌਰ 'ਤੇ ਸਿੱਖ ਧਰਮ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਹੀ ਕਹਿ ਦੀਏ ਕਿ ਪਿਆਰ ਪ੍ਰਗਟਾਇਆ ਜਾਂਦਾ ਸੀ ਅਤੇ ਮੈਨੂੰ ਉਸ ਟਾਈਮ ਇੰਨੀ ਜ਼ਿਆਦਾ ਸੇਧ ਨਾ ਸੋਝ ਨਾ ਹੋਣ ਦੇ ਬਾਵਜੂਦ ਮੈਂ ਆਪਣੇ ਪਰਿਵਾਰ ਤੋਂ ਪਰਿਵਾਰਕ ਮੈਂਬਰਾਂ ਤੋਂ ਜਦੋਂ ਪਤਾ ਕੀਤਾ ਕਿ ਵਿਸਾਖੀ ਵਾਲੇ ਦਿਨ ਕੀ ਹੋਇਆ ਸੀ ਤਾਂ ਮੈਨੂੰ ਮੇਰੇ ਮਾਤਾ ਪਿਤਾ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਸਾਡੇ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਸਿੱਖ ਧਰਮ ਦੇ ਦਸਵੇਂ ਗੁਰੂ ਸੀ ਉਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਤਾਂ ਮੈਨੂੰ ਵੀ ਕਾਫੀ ਜੋਸ਼ ਜਾਂ ਸਪਿਰਿਟ ਮੇਰੇ ਅੰਦਰ ਪੈਦਾ ਹੋਈ ਅਤੇ ਮੇਰੇ ਅੰਦਰ ਵੀ ਬਹੁਤ ਹੀ ਖੁਸ਼ੀ ਦੀ ਭਾਵਨਾ ਪੈਦਾ ਹੋਈ ਕਿ ਮੈਂ ਵੀ ਅੰਮ੍ਰਿਤ ਛਕ ਕੇ ਸਿੰਘ ਸਜਿਆ ਤਾਂ ਮੈਨੂੰ ਵੀ ਵਿਸਾਖੀ ਵਾਲੇ ਦਿਨ ਬਚਪਨ ਦੇ ਵਿੱਚ ਅੰਮ੍ਰਿਤ ਛਕਣ ਦੀ ਦਾਤ ਦਾ ਮੌਕਾ ਮਿਲ ਗਿਆ